ਹਾਂਜੀ ਹਾਂਜੀ ਸਰ ਹਾਂਜੀ ਸਾਹਿਬ ਹਾਂਜੀ ਹਾਂਜੀ ਹਾਂਜੀ ਹਾਂਜੀ ਮਿਲ ਜਾਵੇਗਾ ਜੀ ਹਾਂਜੀ ਕੰਪਨੀ ਤਕਰੀਬਨ ਸਾਰੀਆਂ ਹੀ ਹੈਗੀਆਂ ਜੀ ਆਪਣੇ ਕੋਲ ਤੁਸੀਂ ਦੱਸੋ ਕਿਹੜੀ ਦਾ ਪਸੰਦ ਕਰੋਗੇ ਹਾਂਜੀ ਹਾਂਜੀ ਰੀਅਲਮੀ ਦੇ ਵਿੱਚ ਵੀ ਮਿਲ ਜਾਵੇਗਾ ਦਸ ਕੁ ਹਜ਼ਾਰ ਦੀ ਰੇਂਜ ਦੇ ਵਿੱਚ ਜੀ ਹਾਂਜੀ ਹਾਂਜੀ ਰੀਅਲਮੀ ਦੇ ਵਿੱਚ ਮਿਲ ਜਾਵੇਗਾ ਜੀ ਵਧੀਆ ਤੁਹਾਨੂੰ ਕੈਮਰਾ ਅਤੇ ਖਾਸ ਕਰਕੇ ਜਿਹੜੀ ਰੈਮ ਹੈ ਅਤੇ ਵਧੀਆ ਮੈਮਰੀ ਮਿਲ ਜਾਵੇਗੀ ਜੀ ਬਾਕੀ ਕਲ ਕਲਰ ਕਿਹੜਾ ਚਾਹੀਦਾ ਜੀ ਆਪਾਂ ਨੂੰ ਨਹੀਂ ਉਹ ਤਕਰੀਬਨ ਜਿਹੜੇ ਮੋਸਟਲੀ ਜ਼ਿਆਦਾ ਕਲਰ ਬਲੈਕ ਮਿਲ ਜਾਵੇਗਾ ਜੀ ਬਲੂ 'ਚ ਵੀ ਆਉਂਦਾ ਸਿਲਵਰ 'ਚ ਆ ਜਾਵੇਗਾ ਜੀ ਹਾਂਜੀ ਹਾਂਜੀ ਹਾਂਜੀ ਸੈਮਸੰਗ ਵੀ ਮਿਲ ਜਾਊਗਾ ਓਪੋ 'ਚ ਲੈ ਲਉ ਵੀਵੋ 'ਚ ਲੈ ਲਉ ਤਕਰੀਬਨ ਸਾਰੀਆਂ ਕੋਪਨੀਆਂ ਦੇ ਵਿੱਚ ਇਸ ਰੇਂਜ ਦੇ ਵਿੱਚ ਜੇ ਤੁਸੀਂ ਚਾਹੁੰਦੇ ਆ ਤਾਂ ਜੋ ਤੁਸੀਂ ਫੀਚਰ ਕਹੇ ਵੀ ਤੁਹਾਨੂੰ ਜਿਹੜਾ ਕੈਮਰਾ ਵਧੀਆ ਚਾਹੀਦਾ ਜਾਂ ਮੈਮਰੀ ਹੈ ਜਾਂ ਤਾਂ ਇਹ ਵਧੀਆ ਮਿਲ ਜਾਣਗੇ ਜੀ ਉਹ ਤੁਸੀਂ ਹਾਂ ਜੇ ਚੰਗੀ ਚੰਗਾ ਹੈ ਜੇ ਤੁਸੀਂ ਇੱਥੇ ਸਟੋਰ 'ਤੇ ਆ ਕੇ ਹੀ ਵਿਜਿਟ ਕਰ ਲਓ ਇੱਕ ਵਾਰੀ ਫਿਰ ਤੁਹਾਨੂੰ ਸਾਰੀਆਂ ਅਸੀਂ ਸੈਮਸੰਗ ਦਾ ਵੀ ਦਿਖਾ ਦੇਵਾਂਗੇ ਜੀ ਓਪੋ ਦਾ ਵੀ ਦਿਖਾ ਦੇਵਾਂਗੇ ਵੀਵੋ ਦਾ ਹੋ ਗਿਆ ਜਿਹੜਾ ਤੁਹਾਨੂੰ ਕੋਈ ਚੰਗਾ ਲੱਗੇਗਾ ਉਹ ਕੰਪੈਰਿਵ ਕਰਕੇ ਤੁਸੀਂ ਦੇਖ ਲੈਣਾ ਜੀ ਹਾਂਜੀ ਨਹੀਂ ਅਸਲ ਦੇ ਵਿੱਚ ਜੇ ਤੁਸੀਂ ਸੈਮਸੰਗ ਦਾ ਲੈਂਦੇ ਤਾਂ ਇਹਦੇ ਨਾਲ ਤੁਹਾਨੂੰ ਹੈਡਫੋਨ ਮਿਲ ਜਾਣਗੇ ਅਤੇ ਜਿਹੜੇ ਤੁਸੀਂ ਚਾਰਜਰ ਦੀ ਗੱਲ ਕਰਦੇ ਹੋ ਤਕਰੀਬਨ ਸਾਰਿਆਂ ਦੇ ਨਾਲ ਵੱਖ ਵੱਖ ਕੰਪਨੀਆਂ ਦੇ ਵੱਖ ਵੱਖ ਆਉਂਦੇ ਨੇ ਅਤੇ ਹਾਂ ਹਾਂ ਨਹੀਂ ਸਾਡੇ ਕੋਲ ਬਹੁਤ ਸਾਰੇ ਅਵੇਲੇਬਲ ਹੈਗੇ ਨੇ ਨਹੀਂ ਜੀ ਐਤਵਾਰ ਨੂੰ ਤਾਂ ਨਹੀਂ ਐਤਵਾਰ ਨੂੰ ਬੰਦ ਹੁੰਦਾ ਸਾਡਾ ਕਲੋਜ ਹੁੰਦਾ ਤੁਸੀਂ ਮੰਡੇ ਵਿਜਿਟ ਕਰ ਲਓ ਬਾਕੀ ਤੁਸੀਂ ਸੱਤ ਦਿਨ ਆ ਸਕਦੇ ਆ ਨੌ ਤੋਂ ਚਾਰ ਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਇਸ ਨੰਬਰ 'ਤੇ ਲੋਕੇਸ਼ਨ ਭੇਜ ਦਿੰਦਾ ਤੁਸੀਂ ਜਦੋਂ ਵੀ ਤੁਹਾਡੇ ਕੋਲ ਸਮਾਂ ਹੋ ਗਿਆ ਆ ਕੇ ਵਿਜਿਟ ਕਰ ਲਓ ਤਾਂ ਜ਼ਿਆਦਾ ਵਧੀਆ ਰਹੇਗਾ ਠੀਕ ਹੈ ਓਕੇ ਥੈਕਯੂ